ਪਟਿਆਲਾ ਜਿਵੇਂ ਕਿ ਪਟਿਆਲਾ ਪਟਿਆਲੇ ਬਾਰੇ ਆਪਾਂ ਸ਼ੁ ਸ਼ੁਰੂ ਤੋਂ ਹੀ ਸੁਣਦੇ ਆ ਪਟਿਆਲੇ ਦਾ ਨਾਮ ਨਾਮ ਅੱਗੇ ਸ਼ਾਹੀ ਸ਼ਹਿਰ ਵੱਜਦਾ ਸ਼ਾਹੀ ਸ਼ਹਿਰ ਹੋਣ ਦੇ ਬਹੁਤ ਸਾਰੇ ਰੀਜਨਜ਼ ਨੇ ਸਭ ਤੋਂ ਪਹਿਲਾ ਰੀਜਨ ਤਾਂ ਇਹ ਹੈ ਕੀ ਕਿ ਪੀੜ੍ਹੀ ਦਰ ਪੀੜ੍ਹੀ ਕੁਛ ਰਵਾਇਤਾਂ ਐਵੇਂ ਚੱਲਦੀਆਂ ਆ ਰਹੀਆਂ ਨੇ ਜੋ ਕਿ ਅੱਜ ਵੀ ਅੱਜ ਦੀ ਯੰਗ ਜਨਰੇਸ਼ਨ 'ਚ ਵੀ ਮੌਜੂਦ ਨੇ ਫੋਰ ਇਗਜਾਮਪਲ ਪਟਿਆਲਾ ਸ਼ਾਹੀ ਪੱਗ ਇਹ ਮਹਾਰਾਜਾ ਮਹਾਰਾਜਾ ਮਹਾਰਾਜਾ ਰਿਆਸਤ ਦੇ ਟਾਈਮ ਤੋਂ ਹੁਣ ਤੱਕ ਚੱਲਦੀ ਆ ਰਹੀ ਹੈ ਉਸ ਤੋਂ ਇਲਾਵਾ ਪਟਿਆਲਾ ਸ਼ਾਹੀ ਜੁੱਤੀ ਪਟਿਆਲਾ ਸ਼ਾਹੀ ਸਲਵਾਰ ਅਤੇ ਆਦਿ ਅਤੇ ਕੁਛ ਅੱਜ ਵੀ ਕਲਾਕਾਰ ਬਹੁਤ ਪਟਿਆਲਾ ਪਟਿਆਲੇ 'ਚ ਮਜ ਮੌਜੂਦ ਨੇ ਜਿਵੇਂ ਕਿ ਜੁੱਤੀ ਦੇ ਵਰਕਰਜ਼ ਹੋ ਗਏ ਤੁਸੀਂ ਦੇਖ ਸਕਦੇ ਹੋ ਕਿਲ੍ਹਾ ਮੁਬਾਰਕ ਦੇ ਨਜ਼ਦੀਕ ਜਿੰਨੀਆਂ ਵੀ ਦੁਕਾਨਾਂ ਨੇ ਉਹ ਸਾਰੀਆਂ ਜੁੱਤੀ ਜੁੱਤੀ ਦੀਆਂ ਸ਼ੋਪਸ ਨੇ ਜਿਹਨਾਂ ਨੂੰ ਪਟਿਆਲਾ ਸ਼ਾਹੀ ਜੁੱਤੀ ਕਿਹਾ ਜਾਂਦਾ ਹੈ ਇਹ ਜਿਹੜੇ ਜੁੱਤੀਆਂ ਦੇ ਵਰਕਰਜ਼ ਨੇ ਇਹ ਸਾਰੇ ਲਗਭਗ ਚਾਰ ਜਾਂ ਪੰਜ ਪੀੜ੍ਹੀਆਂ ਤੋਂ ਆਪਣਾ ਕੰਮ ਕਰਦੇ ਆ ਰਹੇ ਨੇ ਇਹ ਪੀੜ੍ਹੀ ਦਰ ਪੀੜ੍ਹੀ ਕੰਮ ਕਰਦੇ ਕਰਦੇ ਇਹ ਇੱਥੇ ਤੱਕ ਪਹੁੰਚੇ ਹਨ ਤਾਂ ਕਰਕੇ ਇਹਨਾਂ ਨੂੰ ਘਰਾਣੇ ਦਾ ਨਾਮ ਦਿੱਤਾ ਗਿਆ ਅੱਜ ਇਹਨਾਂ ਨੂੰ ਪਟਿਆਲਾ ਘਰਾਣੇ ਦੇ ਨਾਮ ਨਾਲ ਜਾਣਿਆ ਜਾਂਦਾ